ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਹਾਂਜੀ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਕੀ ਹੋ ਰਿਹਾ ਹਾਂਜੀ ਮੈਮ ਹੋ ਤਾਂ ਗਈ ਹੈ ਸਾਰੀ ਸੈਟਿੰਗ ਤਕਰੀਬਨ ਸਾਰੀ ਹੋ ਗਈ ਆ ਚਲੋ ਬਾਕੀ ਤਾਂ ਜਿਹੜੀ ਰਹਿੰਦੀ ਖੁੰਹਦੀ ਆ ਹੌਲੀ ਹੌਲੀ ਹੁੰਦੀ ਰਹੂੰਗੀ ਅਤੇ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਪੁੱਛਣਾ ਸੀ ਮੈਮ ਮੈਂ ਸੁਣਿਆ ਕਿ ਪੰਜਾਬ ਦੇ ਵਿੱਚ ਸਵੈਟਰ ਫੁਲਕਾਰੀਆਂ ਸੂਟਸ ਇਹ ਬੜੇ ਸੋਹਣੇ ਸੋਹਣੇ ਮਿਲਦੇ ਨੇ ਅਤੇ ਪਲੀਸ ਮੈਨੂੰ ਗਾਈਡ ਕਰਿਓ ਜ਼ਰਾ ਵੀ ਮੈਂ ਕਿੱਥੋਂ ਕਿੱਥੋਂ ਲਵਾ ਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਅਤੇ ਮੈਮ ਮਤਲਬ ਰੇਟ ਵਗੈਰਾ ਠੀਕ ਮਿਲ ਜਾਣਗੇ ਅੱਛਾ ਜੀ ਠੀਕ ਹੈ ਜੀ ਚਲੋ ਜੇ ਮੈਂ ਹੋਰ ਵੀ ਇਨਫੋਰਮੇਸ਼ਨ ਲੈਣੀ ਹੋਊਗੀ ਜਦ ਮਾਰਕੀਟ ਜਾਊਂਗੀ ਅਤੇ ਫਿਰ ਮੈਂ ਤੁਹਾਨੂੰ ਕੋਲ ਕਰਾਂਗੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਬਹੁਤ ਧੰਨਵਾਦ